ਅਸੀਂ ਆਪਣੇ ਘਰਾਂ ਵਿੱਚ ਕੱਚਾ ਥਾਂ ਰੱਖਿਆ ਹੁੰਦਾ ਹੈ ਜਿਸ ਵਿੱਚ ਅਸੀਂ ਸਬਜ਼ੀ ਵੀ ਲਾ ਲੈਂਦੇ ਹਾਂ ਔਰ ਧਨੀਆ ਅਤੇ ਮੇਥੀ ਅਤੇ ਪਾਲਕ ਵੀ ਬੀਜ ਲਈ ਦੀ ਹੈ ਉਹਨੂੰ ਅਸੀਂ ਜਦੋਂ ਸਬਜ਼ੀ ਬਣਾਉਂਦੇ ਹਾਂ ਅਤੇ ਵ ਵਧੀਆ ਹਰੀ ਹਰੀ ਕੱਟ ਕੇ ਨਾਲ ਦੀ ਨਾਲ ਸਬਜ਼ੀ 'ਚ ਪਾਉਂਦੇ ਹਾਂ ਤਾਂ ਸਬਜ਼ੀ ਬਹੁਤ ਸਵਾਦ ਬਣਦੀ ਹੈ ਅਤੇ ਸਾਰੇ ਖਾ ਕੇ ਆਖਣਗੇ ਘਰ ਦੀ ਸਬਜ਼ੀ ਵਰਗੀ ਕੋਈ ਚੀਜ਼ ਨਹੀਂ ਬਣਦੀ ਪਰ ਬਜ਼ਾਰੋਂ ਲੈ ਕੇ ਆਈਏ ਤਾਂ ਉਹ ਜਮਾਂ ਚੰਗੀ ਨਹੀਂ ਬਣਦੀ ਕਦੇ ਤਾਂ ਗਲਦੀ ਨਹੀਂ ਕਦੇ ਕੁਛ ਹੋ ਜਾਂਦਾ ਕਦੇ ਕੁਛ ਕੋਈ ਵੀ ਸਵਾਦ ਨਾਲ ਉਹਨੂੰ ਨਹੀਂ ਖਾਂਦਾ ਘਰ ਵਾਲੀ ਚੀਜ਼ ਵਰਗਾ ਮਜ਼ਾ ਨਹੀਂ ਆਉਂਦਾ